ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭੰਗੜਾ ਪੰਜਾਬ ਦਾ ਮਸ਼ਹੂਰ ਨਾਚ ਹੈ ਹਰ ਖੁਸ਼ੀ ਦੇ ਮੌਕੇ 'ਤੇ ਭੰਗੜਾ ਜ਼ਰੂਰ ਪਾਇਆ ਜਾਂਦਾ ਹੈ ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ ਜਿੱਥੇ ਕਿਤੇ ਵੀ ਪੰਜਾਬੀ ਵੱਸਦੇ ਹਨ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਭੰਗੜਾ ਨਾ ਪਾਇਆ ਜਾਵੇ ਭੰਗੜਾ ਪੰਜਾਬ ਦੇ ਕਿਸਾਨਾਂ ਵੱਲੋਂ ਫ਼ਸਲ ਪੱਕਣ ਦੀ ਖੁਸ਼ੀ ਵਿੱਚ ਵਿਸਾਖੀ ਦੇ ਤਿਉਹਾਰ 'ਤੇ ਵੀ ਪਾਇਆ ਜਾਂਦਾ ਹੈ ਭੰਗੜਾ ਆਮ ਘਰਾਂ ਵਿੱਚ ਵਿਆਹਾਂ ਵਿੱਚ ਮੇਲਿਆਂ ਵਿੱਚ ਫ਼ਸਲ ਪੱਕਣ ਦੀ ਖੁਸ਼ੀ ਅਤੇ ਹੋਰ ਖੁਸ਼ੀ ਦੇ ਮੌਕਿਆਂ ਵਿੱਚ ਵੀ ਪਾਇਆ ਜਾਂਦਾ ਹੈ ਭੰਗੜੇ ਵਿੱਚ ਢੋਲ 'ਤੇ ਨੱਚਿਆ ਜਾਂਦਾ ਹੈ ਪੰਜਾਬ ਦਾ ਇਹ ਲੋਕ ਨਾਚ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਪ੍ਰਚਲਿਤ ਹੈ ਢੋਲ ਭੰਗੜੇ ਦਾ ਮੁੱਖ ਸਾਜ਼ ਹੈ ਇਸ ਤੋਂ ਬਿਨ੍ਹਾਂ ਹੋਰ ਸਾਜ਼ ਜਿਵੇਂ ਸੱਪ ਕਾਟੋ ਅਲਗੋਜੇ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਪੰਜਾਬੀ ਲੋਕ ਨਾਚ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦੀ ਸੋਮ ਸੁਨਹਿਰੀ ਅਤੇ ਰੌਣਕਾਂ ਭਰੀ ਤਸਵੀਰ ਹੈ ਇਹ ਪੰਜਾਬੀ ਲੋਕਾਂ ਦੀ ਸੱਚ 'ਤੇ ਤੁਲਦੀ ਜ਼ਬਾਨ ਹੈ ਭੰਗੜਾ ਗੱਭਰੂਆਂ ਦਾ ਨਾਚ ਹੈ ਜਦੋਂ ਕਿ ਗਿੱਧਾ ਮੁਟਿਆਰਾਂ ਦਾ ਨਾਚ ਹੈ ਸੰਗੀਤ ਦੀ ਭਾਵਨਾ ਦੇ ਖੁੱਲ੍ਹੇ ਦਿਲ ਅਤੇ ਅਨਿਸ਼ਚਿਤ ਵਹਾਅ ਨੂੰ ਬਾਹਰ ਕੱਢਿਆ ਗਿਆ ਹੈ ਜੋ ਲੋਕਾਂ ਨੂੰ ਸ਼ਕਤੀਸ਼ਾਲੀ ਤਰੀਕੇ ਨਾਲ ਭੰਗੜਾ ਪਾਉਣ ਦੀ ਇਜਾਜ਼ਤ ਦਿੰਦਾ ਹੈ ਜਿਸ ਨਾਲ ਬਹੁਤ ਖੁਸ਼ੀ ਮਿਲਦੀ ਹੈ ਅਤੇ ਤਨਾਅ ਵੀ ਘੱਟਦਾ ਹੈ ਭੰਗੜੇ ਦੀਆਂ ਮੁੱਖ ਕਿਸਮਾਂ ਧਮਾਲ ਝੂਮਰ ਲੁੱਡੀ ਗੁਟਕਾ ਸੰਮੀ ਅਤੇ ਕਿੱਕਲੀ ਹਨ ਭੰਗੜਾ ਕਰਦੇ ਹੋਏ ਪਰੰਪਰਾਗਤ ਆਦਮੀ ਚਾਦਰਾ ਪਹਿਨਦੇ ਹਨ ਅਤੇ ਸਿਰ ਉੱਤੇ ਤੁਰਲੇ ਵਾਲੀ ਪੱਗ ਪਹਿਨਦੇ ਹਨ ਭੰਗੜਾ ਪਾਉਣ ਨਾਲ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ ਇਸ ਕਰਕੇ ਪੰਜਾਬ ਵਿੱਚ ਭੰਗੜਾ ਬਹੁਤ ਮਸ਼ਹੂਰ ਹੈ ਮੈਨੂੰ ਵੀ ਭੰਗੜਾ ਪਾਉਣਾ ਬਹੁਤ ਪਸੰਦ ਹੈ ਇਸ ਨਾਲ ਮੈਨੂੰ ਮਨ ਦੀ ਖੁਸ਼ੀ ਮਿਲਦੀ ਹੈ ਮੈਂ ਕਈ ਵਾਰ ਆਪਣੇ ਸਕੂਲ ਵਿੱਚ ਵੀ ਭੰਗੜੇ ਦੇ ਪ੍ਰੋਗਰਾਮਾਂ ਵਿੱਚ ਕਈ ਵਾਰ ਹਿੱਸਾ ਲਿਆ ਹੈ